ਪੰਜਾਬ ਵਿੱਚ ਖੇਡ ਖੇਤਰ ਵਿੱਚ ਸੁਰੱਖਿਆ ਅਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਸਿਹਤ ਅਤੇ ਸੁਰੱਖਿਆ ਨਿਯਮਾਂ ਨੂੰ ਪੂਰਨ ਕਰਨ ਲਈ ਸਾਧਾਰਨ ਲੋਕਾਂ ਨੂੰ ਸੱਚੇ ਸੁਰੱਖਿਆ ਉਪਕਰਣ ਵੀ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਸਨੂੰ ਸਿਰਫ਼ ਸੁਇਖ਼ਿਆ ਦੇ ਨਿਯਮਾਂ ਦੀ ਪਾਲਣ ਨਾਲ ਹੀ ਨਹੀ ਬਲ ਕਿ ਕਿਸੇ ਹਾਦਸੇ ਨੂੰ ਰੋਕਣ ਅਤੇ ਇਲਾਜ ਕਰਨ ਲਈ ਤਿਆਰੀ ਵੀ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਬਾਅਦ ਹਰ ਸਮੱਸਿਆ ਦੀ ਪੁਨਰਵਾਸ ਪ੍ਰਕਿਰਿਆ ਵੀ ਅਮਲ ਆਈ ਜਾਣੀ ਚਾਹੀਦੀ ਹੈ ਇਸ ਪ੍ਰਕਾਰ ਖੇਡ ਖੇਤਰ ਵਿੱਚ ਹੁਣ ਦਾ ਵਾਤਾਵਰਣ ਸੁਰੱਖਿਅਤ ਅਤੇ ਸੁਰੱਖਿਆ ਵਾਲਾ ਬਣਾਇਆ ਜਾ ਸਕਦਾ ਹੈ ਪੰਜਾਬ ਵਿੱਚ ਖੇਡ ਖੇਤਰ ਵਿੱਚ ਸੁਰੱਖਿਆ ਦੀ ਚਿਗਾੜੀ ਕਰਨ ਲਈ ਸਰਕਾਰ ਦੇ ਅਤੇ ਸਮੂਹ ਸ ਸਮਾਜ ਦੀ ਦੇ ਸਹਿਯੋਗ ਦੀ ਲੋੜ ਹੈ ਨਵੀਨਤਮ ਸੁਰੱਖਿਆ ਤਥਾ ਸਰੰਚਾ ਸਰੰਚਨਾਤਮਿਕ ਸਦੰਬਰਾ ਨੂੰ ਵਿਚਕਾਰ ਕੇ ਖੇਡ ਖੇਤਰ ਨੂੰ ਸੁਰੱਖਿਆ ਸਮੱਸਿਆਵਾਂ ਦੇ ਹੱਲ ਵਿੱਚ ਪ੍ਰਗਟੇਰਤਾ ਬਣਾਉਣਾ ਬਹੁਤ ਜ਼ਰੂਰੀ ਹੈ ਵਿਭਿੰਨ ਸੰਗਠਨਾਂ ਸਰਕਾਰੀ ਅਤੇ ਗੈਰ ਸਰਕਾਰੀ ਸਹਿਯੋਗੀ ਸੰਗਠਨਾਂ ਨੂੰ ਇਸ ਕਾਰਗਰ ਤਰੀਕੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਸੁਰੱਖਿਆ ਪਰੋਟੋਕੋਲ ਅਤੇ ਕਾਨੂੰਨੀ ਨਿਯਮਾਂ ਦੀ ਪਾਲਣ ਕਰਨਾ ਨਾਗਰ ਨਾਗਰਿਕ ਸਮਾਜ ਨੂੰ ਸੁਰੱਖਿਆ ਦੀ ਚੇਤਨਾ ਵਧਾਉਣ ਦੇ ਲਈ ਸਾਰੇ ਅੰਗ ਸੰਗਠਨ ਮਿਲ ਕੇ ਕੰਮ ਕਰਨ ਕਰਦੇ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਖੇਡ ਖੇਤਰ ਵਿੱਚ ਸੁਰੱਖਿਆ ਨੂੰ ਅਤੇ ਹਾਦਸੇ ਦੇ ਹੱਲ ਕਰਨ ਲਈ ਅਤੇ ਰੋਕ ਥਾਮ ਤੱਤਾਂ ਨੂੰ ਬੈਹਤਰੀਨ ਤਰੀਕੇ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ